ਹਾਂਜੀ ਮੈਂ ਨੌਜਵਾਨ ਪੀੜ੍ਹੀ ਨੂੰ ਖ਼ਬਰਾਂ ਦੀ ਪਾਲਣਾ ਕਰਨ ਲਈ ਉਤਾਹੀ ਉਤਸ਼ਾਹਿਤ ਕਰਦਾ ਹਾਂ ਕਿਉਂਕਿ ਇਸ ਨਾਲ ਕਈ ਫਾਈਦੇ ਹਨ ਕਿ ਸਾਨੂੰ ਦੀਨ ਦੁਨੀਆ ਬਾਰੇ ਪਤਾ ਲੱਗਦਾ ਹੈ ਕਿ ਕਿੱਥੇ ਕਿਆ ਹੋ ਰਿਹਾ ਹੈ ਜੌਬਸ ਅਪੋਰਚੁਨਟੀਜ਼ ਬਾਰੇ ਵੀ ਨਿਊਜ਼ ਪੇਪਰ ਤੋਂ ਪਤਾ ਲੱਗਦਾ ਹੈ ਅਤੇ ਇਹਦੇ ਫਾਈਦੇ ਇਹ ਹਨ ਕਿ ਸਾਡੀ ਰੀਡਿੰਗ ਸਕਿੱਲ ਵ ਵਧਦੀ ਹੈ ਅਤੇ ਸਾਡੀ ਨੌਲੇਜ ਵੀ ਵਧਦੀ ਹੈ